ਹਰੇਕ ਰਾਜ ਅਤੇ ਖੇਤਰ ਦਾ ਆਪਣਾ ਹੀ ਇੱਕ ਸੱਭਿਆਚਾਰ ਹੁੰਦਾ ਹੈ ਪੰਜਾਬ ਦਾ ਸੱਭਿਆਚਾਰ ਬਹੁਤ ਹੀ ਅਮੀਰ ਅਤੇ ਵਿਸ਼ਾਲ ਹੈ ਇਸ ਦੀ ਤੁਲਨਾ ਕਿਸੇ ਵੀ ਹੋਰ ਰਾਜ ਨਾਲ ਨਹੀਂ ਕੀਤੀ ਜਾ ਸਕਦੀ ਪੰਜਾਬ ਵਿੱਚ ਬਹੁਤ ਸਾਰੇ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਵਿਸ਼ਵਾਸ ਹਨ ਜਿਨ੍ਹਾਂ ਨੂੰ ਅੱਜ ਮੈਂ ਸ਼ਾਮਿਲ ਕਰਨ ਜਾ ਰਹੀ ਹਾਂ ਸਭ ਤੋਂ ਮਨ ਮੁੱਖ ਸੱਭਿਆਚਾਰਕ ਮੂਲ ਹੈ ਮਿਹਨਤ ਮਿਹਨਤ ਕਰਕੇ ਮਨੁੱਖ ਆਪਣੇ ਕਿਸੇ ਵੀ ਮੁਕਾਮ ਤੱਕ ਪਹੁੰਚ ਸਕਦਾ ਹੈ ਪੰਜਾਬੀ ਲੋਕ ਮਿਹਨਤ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ ਉਹ ਆਪਣੇ ਹੱਥੀਂ ਕਿਰਤ ਨੂੰ ਹੀ ਇੱਕ ਮੁੱਖ ਕਿੱਤਾ ਮੰਨਦੇ ਹਨ ਅੱਜ ਕੱਲ੍ਹ ਦੇ ਸਮੇਂ ਵਿੱਚ ਅਜੋਕੀ ਪੀੜੀ ਬਾਹਰ ਦੀਆਂ ਵਿਦੇਸ਼ਾਂ ਵਿੱਚ ਮੋਹਿਤ ਹੋ ਰਹੀ ਹੈ ਪਰ ਹਾਲੇ ਵੀ ਕੁਛ ਲੋਕ ਇੱਦਾਂ ਦੇ ਹਨ ਜਿਹੜੇ ਮਿਹਨਤ 'ਤੇ ਬਹੁਤ ਵਿਸ਼ਵਾਸ ਕਰਦੇ ਹਨ ਅਤੇ ਹੱਥੀਂ ਕਿਰਤ ਕਰਨ ਨੂੰ ਹੀ ਆਪਣਾ ਮੁੱਖ ਕਿੱਤਾ ਮੰਨਦੇ ਹਨ ਸੰਗੀਤ ਦੀ ਗੱਲ ਕੀਤੀ ਜਾਵੇ ਤਾਂ ਸੰਗੀਤ ਵੀ ਇੱਕ ਅਜਿਹਾ ਵਿਸ਼ਾ ਹੈ ਪੰਜਾਬ ਨਾਲ ਸੰਬੰਧਿਤ ਜੋ ਸਾਡੇ ਸੱਭਿਆਚਾਰ ਨੂੰ ਦੂਰ ਦੂਰ ਤੱਕ ਲੈ ਕੇ ਜਾ ਰਿਹਾ ਹੈ ਹਰੇਕ ਮਨੁੱਖ ਪੰਜਾਬੀ ਸੰਗੀਤ ਤੋਂ ਪ੍ਰਭਾਵਿਤ ਹੋ ਰਿਹਾ ਹੈ ਚਾਹੇ ਉਹ ਪੰਜਾਬ ਤੋਂ ਬਾਹਰ ਬੈਠੇ ਲੋਕ ਹਨ ਉਹ ਵੀ ਪੰਜਾਬੀ ਸੰਗੀਤ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ ਉਹਨਾਂ 'ਤੇ ਵੀ ਇੰਨਾ ਅਸਰ ਕਰ ਰਿਹਾ ਹੈ ਕਿ ਉਹਨਾਂ ਨੇ ਵੀ ਆਪਣੇ ਸੱਭਿਆਚਾਰ ਵਿੱਚ ਵੀ ਪੰਜਾਬੀ ਸੱਭਿਆਚਾਰ ਨੂੰ ਸ਼ਾਮਿਲ ਕੀਤਾ ਗਿਆ ਕਰ ਲਿਆ ਹੈ ਅਤੇ ਉਹ ਸੰਗੀਤ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਗੀਤ ਨੂੰ ਹੀ ਸਨਮਾਨਿਤ ਦੇ ਰਹੇ ਹਨ ਪੰਜਾਬ ਦੇ ਲੋਕ ਬਹੁਤ ਧਾਰਮਿਕ ਵੀ ਹਨ ਉਹ ਹਰ ਕੰਮ ਨੂੰ ਕਰਨ ਲਈ ਧਰਮ ਦਾ ਪ੍ਰਚਾਰ ਕਰਦੇ ਹਨ ਉਹ ਧਰਮ ਧਾਰਮਿਕ ਭਾਵਨਾਵਾਂ ਨੂੰ ਰੱਖਦੇ ਹਨ ਧਾਰਮਿਕ ਕਰਮਾਂ ਕਰਕੇ ਹੀ ਉਹਨਾਂ ਨੇ ਪਰਮਾਤਮਾ ਦੇ ਇੰਨੇ ਨੇੜੇ ਹਨ ਕਿ ਉਹ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਜਾਂ ਅਖੀਰ 'ਤੇ ਹਰ ਕੰਮ ਦੀ ਸਮਾਪਤੀ ਵੇਲੇ ਉਹ ਪਰਮਾਤਮਾ ਨੂੰ ਹੀ ਧਿਆਉਂਦੇ ਹਨ ਅਤੇ ਹਰ ਕੰਮ ਵਿੱਚ ਇੱਕ ਧਾਰਮਿਕ ਭਾਵਨਾ ਰੱਖ ਕੇ ਸੱਚੀ ਸੁੱਚੀ ਅਤੇ ਭਾਵਨਾ ਰੱਖ ਕੇ ਸ਼ਰਧਾ ਦੇ ਨਾਲ ਹੀ ਹਰ ਕੰਮ ਨੂੰ ਨੇਪਰੇ ਚਾੜ੍ਹਦੇ ਹਨ